ਸਮੁੰਦਰ ਦਾ ਜਿਹੜਾ ਨਜ਼ਾਰਾ ਉਹ ਵ ਇੱਕ ਵੱਖਰਾ ਨਜ਼ਾਰਾ ਹੈ ਮੈਂ ਗੋਆ ਬੀਚ 'ਤੇ ਕਈ ਵਾਰੀ ਜਾ ਕੇ ਘੁੰਮ ਕੇ ਆਇਆ ਸਮੁੰਦਰ ਦਾ ਜਿਹੜਾ ਕ ਅਨੁਭਵ ਉਹਦਾ ਅਲੱਗ ਹੈ ਉਹਨੂੰ ਸ਼ਬਦਾਂ ਵਿੱਚ ਆਪਾਂ ਬਿਆਨ ਏ ਨਹੀਂ ਕਰ ਸਕਦੇ ਜਿੱਥੇ ਤੱਕ ਰਹੀ ਗੱਲ ਪਹਾੜਾਂ ਦੀ ਪਹਾੜਾਂ 'ਚ ਤਾਂ ਸਾਡਾ ਤਕਰੀਬਨ ਸਾਲ ਦੋ ਸਾਲ ਬਾਅਦ ਇੱਧਰ ਸ਼ਿਮਲਾ ਕੁੱਲੂ ਮਨਾਲੀ ਕੁਫ਼ਰੀ ਬ ਸਾਈਡ ਬਡ ਗੇੜਾ ਲੱਗ ਜਾਂਦਾ ਹੈ ਪਹਾੜਾਂ ਦਾ ਜਿਹੜਾ ਮੌਸਮ ਹੈ ਬਹੁਤ ਆਨੰਦਮਈ ਬਹੁਤ ਜ਼ੈਕੇਦਾਰ ਹੁੰਦਾ ਹੈ ਹਾਂ ਨਾਲੇ ਇਥੋਂ ਧੂੰਆਂ ਤਾਂ ਵਗੈਰਾ ਤੋਂ ਬਚ ਕੇ ਕੁਛ ਦੇਰ ਰਹਿਣ ਦਾ ਉੱਥੇ ਆਨੰਦ ਇਹ ਹੋਰ ਹੈ ਰਹੀ ਗੱਲ ਇਤਿਹਾਸਿਕ ਸਥਾਨਾਂ ਦੀ ਇਤਿਹਾਸਿਕ ਸਥਾਨ ਜਿਵੇਂ ਕਿ ਦੁਰਗਿਆਣਾ ਗੁਰਦੁਆਰਾ ਦਰਬਾਰ ਸਾਹਿਬ ਅੰਬਰਸਰ ਅਨੰਦਪੁਰ ਸਾਹਿਬ ਗੁਰਦੁਆਰਾ ਸਾਡਾ ਲੋਕਲ ਫਤਿਹਗੜ੍ਹ ਸਾਹਿਬ ਅਤੇ ਹੋਰ ਵੀ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਦੇ ਵੀ ਹੁਣ ਤਾਂ ਦਰਸ਼ਨ ਕੀਤੇ ਹਨ ਜੋ ਕਿ ਪਾਕਿਸਤਾਨ ਵਿੱਚ ਹੈ ਰਹੀ ਗੱਲ ਮੰਦਰਾਂ ਦੀ ਮੰਦਰਾਂ ਵਿੱਚ ਦੁਰਗਿਆਣਾ ਮੰਦਿਰ ਅੰਬਰਸਰ ਕਾਲੀ ਮਾਤਾ ਦਾ ਮੰਦਰ ਪਟਿਆਲੇ ਨੈਣਾਂ ਦੇਵੀ ਜਵਾਲਾ ਜੀ ਸ਼ੇਰਾਂ ਵਾਲੀ ਮੰਦਰ ਵਾਲੀ ਦੇ ਦਰਸ਼ਨ ਕੀਤੇ ਜਿੱਥੇ ਕਿ ਬਹੁਤ ਆਨੰਦ ਆਉਂਦਾ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਾਂ ਮੇਰਾ ਰਿਸ਼ਤੇ ਜਿਹੜੇ ਨਾਨਕੇ ਨੇ ਉਹ ਸਮਰਾਲੇ ਨੇ ਸਮਰਾਲੇ ਜਾਣ ਦਾ ਇੱਕ ਅੱਡੇ ਨਾ ਨਾਨਕਿਆਂ ਦਾ ਆਨੰਦ ਹੁੰਦਾ ਉੱਥੇ ਜੋ ਆਪਣਾ ਖਾਣ ਪੀਣ ਦਾ ਪਸੰਦ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਬਹੁਤ ਸੇਵਾ ਹੁੰਦੀ ਹੈ ਸ਼ਹਿਰ ਦਾ ਘੁੰਮਣ ਫਿਰਨਾ ਸਾਡੇ ਵਾਸਤੇ ਪਿੰਡ ਵਾਲਿਆਂ ਵਾਸਤੇ ਇੱਕ ਅਲੱਗ ਚੀਜ਼ ਰਹਿੰਦੀ ਹੈ ਜੇ ਹੋਰ ਰਿਸ਼ਤੇਦਾਰਾਂ ਦੀ ਗੱਲ ਕਰੀਆਂ ਗੱਲ ਕਰਾਂ ਤਾਂ ਮੇਰੇ ਮਾਸੀ ਹੈ ਇੱਕ ਚੰਡੀਗੜ੍ਹ ਰਹਿੰਦੀ ਹੈ ਚੰਡੀਗੜ੍ਹ ਘੁੰਮਣ ਦਾ ਚੱਲੋ ਬਹਾਨੇ ਨਾਲ ਨਾਲੇ ਇੱਕ ਅਨ ਅੱਡ ਆਨੰਦ ਹੈ ਉਹਦੇ ਨਾਲ ਵੀ ਕ ਚੰਡੀਗੜ੍ਹ ਦੇ ਵੇ ਗੇੜਾ ਲੱਗ ਜਾਂਦਾ ਹੈ ਹੋਰ ਵੀ ਜੇ ਕੋਈ ਕੰਮ ਕਾਰ ਹੁੰਦਾ ਚ ਚੰਡੀਗੜ੍ਹ ਰਿਸ਼ਤੇਦਾਰੀ 'ਚ ਰਹਿ ਕੇ ਉੱਥੇ ਬੰਦਾ ਆਰਾਮ ਨਾਲ ਸਾਡੀ ਰਾਜਧਾਨੀ ਆ ਪੰਜਾਬ ਦੀ ਕਰ ਲੈਂਦਾ ਹੈ ਇਸ ਤਰ੍ਹਾਂ ਹੋਰ ਵੀ ਰਿਸ਼ਤੇਦਾਰਾਂ ਦੀ ਸਾਡੀ ਭੂਆ ਹੈ ਉਹ ਲੁਧਿਆਣੇ ਹੈ ਲੁਧਿਆਣੇ ਦਾ ਵੀ ਬੜਾ ਸ਼ਹਿਰ ਦਾ ਅੱਡ ਸਵਾਦ ਹੈ ਜਿਹੜੇ ਲੁਧਿਆਣੇ ਦੀ ਸ਼ ਭੀੜ ਭਾੜ ਹੈ ਉਹ ਕਿਤੇ ਹੋਰ ਸ਼ਹਿਰ 'ਚ ਨਹੀਂ ਮਿਲਦੀ ਨਾ ਇਹੋ ਜਿਹੀ ਆਵਾਜਾਈ ਜਿਹੜੀ ਲੁਧਿਆਣੇ ਜ਼ਰੂਰ ਮੁਸ਼ਕਿਲ ਹੈ ਪਰ ਲੁਧਿਆਣੇ ਸ਼ਹਿਰ ਦਾ ਵੀ ਇੱਕ ਅੱਡ ਆਨੰਦ ਹੈ